ਦੁੱਧ ਚੋਣ ਸਮੇਂ ਪਸ਼ੂ ਨੂੰ ਗੁੱਸਾ ਇਸ ਕਰਕੇ ਆ ਜਾਂਦਾ ਹੈ ਕਿ ਕੋਈ ਹੋਰ ਜੇ ਵਿਅਕਤੀ ਦੁੱਧ ਚੋਣ ਲੱਗ ਜੇ ਜਿਹੜਾ ਰੋਜ਼ ਨਹੀਂ ਚੋਂਦਾ ਤਾਂ ਤਾਂ ਪੰਛੀ ਨੂੰ ਬਹੁਤ ਜਲਦੀ ਇਰੀਟੇਸ਼ਨ ਹੁੰਦੀ ਹੈ ਅਤੇ ਉਹ ਗੁੱਸਾ ਦਿਖਾਉਣ ਲੱਗ ਜਾਂਦਾ ਹੈ ਪਸ਼ੂ ਵੀ ਆਪਣੇ ਵਿਅਕਤੀ ਨੂੰ ਚੰਗੀ ਤਰ੍ਹਾਂ ਪਹਿਚਾਣਦਾ ਹੈ ਹੱਥਾਂ ਦੀ ਉਸ ਨੂੰ ਪਹਿਚਾਣ ਹੁੰਦੀ ਹੈ ਅਤੇ ਜਿੰਨੀ ਦੇਰ ਦੁੱਧ ਦੀ ਧਾਰਾਂ ਨੂੰ ਚੰਗੀ ਤਰ੍ਹਾਂ ਧੋ ਕੇ ਦੁੱਧ ਨੂੰ ਨਾ ਚੁੰਗਿਆ ਜਾਵੇ ਤਾਂ ਤਾਂ ਵੀ ਪਸ਼ੂ ਗੁੱਸਾ ਕਰ ਲੈਂਦੇ ਹਨ ਅਤੇ ਸਭ ਤੋਂ ਪਹਿਲਾਂ ਉਸ ਦੇ ਥੰਨਾ ਨੂੰ ਉਨਦੇ ਬੱਚੇ ਕੱਟੇ ਜਾਂ ਵੱਛੀ ਕੱਟੀ ਉਸਦੇ ਬੱਚੇ ਨੂੰ ਚੁੰਗਾਇਆ ਜਾਂਦਾ ਹੈ ਜਿਸ ਤਰ੍ਹਾਂ ਥਣ ਨੋਰਮਲ ਹੋ ਜਾਣ ਅਤੇ ਉਹ ਸਹੀ ਤਰ੍ਹਾਂ ਧਾਰਾਂ ਨਿਕਲ ਸਕਣ ਜੇ ਅਸੀਂ ਦੁੱਧ ਪਹਿਲੇ ਬੱਚਿਆਂ ਪਸ਼ੂ ਦੇ ਬੱਚਿਆਂ ਨੂੰ ਨਾ ਪਿਲਾਇਆ ਤਾਂ ਉਹ ਪਸ਼ੂ ਗੁੱਸਾ ਦਿਖਾਉਂਦੇ ਹਨ ਅਤੇ ਉਹਦੇ ਥਨਾਂ ਨੂੰ ਕਰਕੇ ਫਿਰ ਉਹ ਦੁੱਧ ਚੋਣ ਦਿੰਦੇ ਹਨ ਅਤੇ ਜੇ ਉਸ ਨੂੰ ਸਹੀ ਤਰ੍ਹਾਂ ਖਾਦ ਨਾ ਪਰੋਸੀ ਜਾਵੇ ਓਨਾ ਚਾਰਾ ਖਾਦ ਖਲ ਆਦਿ ਦੀ ਧਿਆਨ ਨਾ ਕੀਤੀ ਜਾਵੇ ਤਾਂ ਵੀ ਪਸ਼ੂ ਗੁੱਸਾ ਕਰਦੇ ਹਨ ਉਹਨਾਂ ਨੂੰ ਸਹੀ ਤਰ੍ਹਾਂ ਨਵਾਉਣਾ ਸਹੀ ਤਰ੍ਹਾਂ ਤਿਆਰ ਕਰਨਾ ਬੱਚਿਆਂ ਤਰਾਂ ਪਿਆਰ ਕਰਨਾ ਅਤੇ ਉਹ ਬੱਚੇ ਇਸ ਤਰ੍ਹਾਂ ਫਿਰ ਉਸਦਾ ਪਸ਼ੂ ਨੂੰ ਕੰਟਰੋਲ ਕੀਤਾ ਜਾਂਦਾ ਹੈ ਜੇ ਉਹਦੇ ਥੰਨਾ ਨੂੰ ਚੰਗੀ ਤਰ੍ਹਾਂ ਧੋ ਕੇ ਦੁੱਧ ਚੁੰਗਿਆ ਜਾਵੇ